ਮੇਰਾ ਨਾਮ ਮੋਨੀਕਾ ਹੈ ਮੈਂ ਤੁਹਾਨੂੰ ਅੱਜ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਲਈ ਸੱਭਿਆਚਾਰਕ ਬਾਰੇ ਕੁਝ ਗੱਲਾਂ ਦੀ ਪਹਿਚਾਣ ਕਰਵਾਉਣਾ ਚਾਹੁੰਦੀ ਹੈ ਉਹਨਾਂ ਨੇ ਅੱਜ ਸਾਰਿਆਂ ਨੂੰ ਇਕੱਠੇ ਰਹਿਣ ਦੇ ਆ ਦੱਸਿਆ ਹੈ ਕਿ ਤੁਸੀਂ ਸਾਰੇ ਜਣੇ ਇਕੱਠੇ ਹੋ ਕੇ ਰਹੋ ਅਤੇ ਉਹਨਾਂ ਨੇ ਆਪਣੇ ਪਿਤਾ ਜੀ ਦਾ ਕਹਿਣਾ ਵੀ ਮੰਨਿਆ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਬਸ ਇੱਕ ਵਾਰ ਹੀ ਕਿਹਾ ਕਿ ਅੱਜ ਸਾਡੇ ਸਾਰੇ ਨੌਕਰ ਆਪੋ ਆਪਣੇ ਕੰਮਾਂ ਉੱਤੇ ਗਏ ਹੋਏ ਸਨ ਫਸਲ ਦੀ ਰਾਖੀ ਕਰਨ ਲਈ ਹੋਰ ਕੋਈ ਵੀ ਨਹੀਂ ਹੈ ਇਸ ਲਈ ਤੂੰ ਪਸ਼ੂਆਂ ਤੋਂ ਫਸਲ ਦੀ ਰਾਖੀ ਕਰਨ ਲਈ ਖੇਤਾਂ ਨੂੰ ਚਲਿਆ ਜਾ ਉਹਨਾਂ ਨੇ ਆਪਣੇ ਪਿਤਾ ਜੀ ਦਾ ਕਹਿਣਾ ਮੰਨ ਕੇ ਅਤੇ ਉਹ ਲੋਕਾਂ ਨੂੰ ਵੀ ਦੱਸਦੇ ਹਨ ਕਿ ਤੁਸੀਂ ਵੀ ਅੱਧਾ ਕੰਮ ਕਰਿਆ ਕਰੋ ਅਤੇ ਉਹ ਖੇਤਾਂ ਨੂੰ ਚਲੇ ਗਏ ਜਦੋਂ ਉਹ ਸਵੇਰ ਨੂੰ ਉੱਠਦੇ ਹਨ ਉਹ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਨਾਮ ਹੀ ਲੈਂਦੇ ਹਨ ਉਹਨਾਂ ਨੇ ਲੋਕਾਂ ਨੂੰ ਵੀ ਏ ਲੋਕਾਂ ਨੂੰ ਵੀ ਦੱਸਿਆ ਕਿ ਤੁਸੀਂ ਵੀ ਸਵੇਰ ਨੂੰ ਉੱਠ ਕੇ ਪਹਿਲਾਂ ਬਾਕੀ ਕੰਮ ਬਾਅਦ ਵਿੱਚ ਪਹਿਲਾਂ ਪ੍ਰਮਾਤਮਾ ਦਾ ਨਾਮ ਹੀ ਲੈਣਾ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਨੇ ਸਭ ਨੂੰ ਇਕੱਠੇ ਰਹਿਣ ਦੀ ਸਿੱਖਿਆ ਦਿੱਤੀ ਉਨ੍ਹਾਂ ਨੇ ਕਿਸ ਸਭ ਨੂੰ ਕਿਹਾ ਕਿ ਰ ਸਭ ਦਾ ਮਾਲਕ ਇੱਕ ਹੁੰਦਾ ਹੈ ਕੋਈ ਵੀ ਸਿੱਖ ਧਰਮ ਦਾ ਜਾਂ ਕ ਮਤਲਬ ਮੁਸਲਿਮ ਸਿੱਖ ਇਸਾਈ ਕੋਈ ਵੀ ਅਲੱਗ ਅਲੱਗ ਨਹੀਂ ਸਾਰਿਆਂ ਨੂੰ ਇਕੱਠਾ ਹੀ ਰਹਿਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਸਭ ਨੂੰ ਇਕੱਠੇ ਰਹਿਣਾ ਚਾਹੀਦਾ ਹੈ ਤਾਂ ਇਸ ਨਾਲ ਸਾਡਾ ਅੱਗੇ ਵੀ ਸੱਭਿਆਚਾਰਕ ਵੱਧਦੀ ਰਹਿੰਦੀ ਹੈ